ਹੈਲੋ ਸਰ ਫਲਿਪਕਾਰਡ ਤੋਂ ਬੋਲਦੇ ਸਰ ਅਸੀਂ ਤੁਹਾਡੇ ਕੋਲੋਂ ਦੋ ਪ੍ਰੋਡਕਟ ਮੰਗਵਾਏ ਸੀ ਜੋ ਕਿ ਦੋਨੋਂ ਸੂਟ ਸੀ ਜੋ ਪਹਿਲਾ ਸੂਟ ਸੀ ਉਹ ਬਹੁਤ ਵਧੀਆ ਨਿਕਲਿਆ ਉਹਦਾ ਕਲਰ ਵੀ ਬਹੁਤ ਸੋਹਣਾ ਸੀ ਫਿਟਿੰਗ ਵੀ ਬਹੁਤ ਵਧੀਆ ਸੀ ਕੱਪੜਾ ਵੀ ਬਹੁਤ ਸੋਹਣਾ ਸੀ ਸਰ ਜੋ ਉਹਨੂੰ ਵੇਖ ਕੇ ਮੈਂ ਦੂਸਰਾ ਪ੍ਰੋਡੈਕਟ ਮੰਗਵਾਇਆ ਸੂਟ ਉਹਦੀ ਲੈਂਥ ਬਹੁਤ ਜ਼ਿਆਦਾ ਸੀ ਉਹਦਾ ਕਲਰ ਵੀ ਸੋਹਣਾ ਨਹੀਂ ਸੀ ਉਹਨੂੰ ਇੱਕ ਜਗ੍ਹਾ 'ਤੇ ਕੱਟ ਵੀ ਲੱਗਿਆ ਹੋਇਆ ਸੀ ਸਰ ਉਹਨੂੰ ਮੈਂ ਜਦੋਂ ਵੋਸ਼ ਕੀਤਾ ਤਾਂ ਉਹਦਾ ਕਲਰ ਵੀ ਉਤਰ ਗਿਆ ਸਰ ਤੁਸੀਂ ਇੱਦਾਂ ਨਾ ਕਰਿਆ ਕਰੋ ਜੋ ਕਿ ਲੋਕ ਖਰਾਬ ਹੁੰਦੇ ਨੇ ਹੁਣ ਮੈਂ ਕਪ ਜੋ ਪ੍ਰੋਡੈਕਟ ਮੰਗਵਾਇਆ ਜੋ ਮੇਰਾ ਖਰਾਬ ਹੋ ਗਿਆ ਮੈਨੂੰ ਨੁਕਸਾਨ ਹੋ ਗਿਆ ਇਸ ਤਰ੍ਹਾਂ ਤੁਹਾਡੀ ਕੰਪਨੀ 'ਤੇ ਕੋਈ ਵਿਸ਼ਵਾਸ ਨਹੀਂ ਕਰੇਗਾ ਤੁਹਾਡਾ ਹੀ ਨਾਮ ਖਰਾਬ ਹੋਵੇਗਾ ਕਿਰਪਾ ਕਰਕੇ ਤੁਸੀਂ ਇਸ ਤਰ੍ਹਾਂ ਖਰਾਬ ਪ੍ਰੋਡਕਟ ਕਿਸੇ ਨੂੰ ਨਾ ਦਿਆ ਕਰੋ ਪ੍ਰੋਡੈਕਟ ਚੰਗਾ ਨਿਕਲੇ ਤਾਂ ਤੁਹਾਡੀ ਵੀ ਸ਼ੋਭਾ ਹੁੰਦੀ ਹੈ ਮਾੜਾ ਪ੍ਰੋਡੈਕਟ ਕਿਸੇ ਨੂੰ ਨਾ ਦਿਆ ਕਰੋ